ਤੇਰ੍ਹਾਂ ਨਵੰਬਰ ਉੱਨੀ ਸੌ ਉਣਾਸੀ ਗਿਆਰ੍ਹਾਂ ਨਵੰਬਰ ਉੱਨੀ ਸੌ ਇਕਿਆਸੀ ਚੌਵੀ ਅਕਤੂਬਰ ਉੱਨੀ ਸੌ ਬਵੰਜਾ ਪੰਜ ਅਕਤੂਬਰ ਦੋ ਹਜ਼ਾਰ ਪੰਦਰਾਂ ਚਾਰ ਅਪ੍ਰੈਲ ਉੱਨੀ ਸੌ ਛਪੰਜਾ ਅੱਠ ਦਸੰਬਰ ਉੱਨੀ ਸੌ ਛਿਹੱਤਰ